ਪੰਜਾਬ ਸਿੱਖਿਆ ਵਿੱਚ ਪਹਿਲਾਂ ਨਾਲੋਂ ਹੁਣ ਤੱਕ ਕਾਫੀ ਬਦਲਾਅ ਆ ਗਿਆ ਪਹਿਲੇ ਬੱਚੇ ਤਕਰੀਬਨ ਸੱਤ ਸਾਲ 'ਚ ਹੁੰਦੇ ਸੀ ਉਦੋਂ ਉਹਨਾਂ ਨੂੰ ਸਕੂਲ ਪਾਇਆ ਜਾਂਦਾ ਸੀਗਾ ਫਿਰ ਬੱਚੇ ਸਿੱਖਦੇ ਹੁੰਦੇ ਸੀਗੇ ਏ ਬੀ ਸੀ ਜਾਂ ਜੋ ਵੀ ਆ ਕ ਖ ਉਦੋਂ ਸ਼ੁਰੂ ਕਰਦੇ ਸੀਗੇ ਅਤੇ ਹੁਣ ਕੀ ਆ ਕਿ ਬੱਚਾ ਢਾਈ ਜਾਂ ਤਿੰਨ ਸਾਲ ਦਾ ਹੀ ਹੁੰਦਾ ਘਰ ਘਰ ਪਲੇਅ ਪੈਨ ਖੁੱਲ੍ਹੇ ਹੋਏ ਆ ਉਹਦੇ ਵਿੱਚ ਮਤਲਬ ਕਿ ਲੋਕ ਬੱਚਿਆਂ ਨੂੰ ਪਹਿਲੇ ਉੱਥੇ ਭੇਜ ਦਿੰਦੇ ਆ ਉੱਥੇ ਬੱਚਾ ਸਟਾਰਟਿੰਗ ਦੇ ਇਹੀ ਚੀਜ਼ਾਂ ਸਿੱਖਦਾ ਜਿਹੜੇ ਕਿ ਉਹਨੇ ਪੰਜ ਛੇ ਸਾਲ ਚਾਰ ਪੰਜ ਸਾਲ ਇਸਦੇ ਘਰ 'ਚ ਬੈਠ ਕੇ ਖੇਡ ਕੇ ਵੇਸਟ ਕੀਤੇ ਹੁੰਦੇ ਆ ਉਹਨੂੰ ਯੂਟੀਲਾਈਜ਼ ਕਰ ਲੈਂਦੇ ਆ ਉਹਦੇ ਵਿੱਚ ਇਹ ਹੁੰਦਾ ਕਿ ਬੱਚਾ ਜਦੋਂ ਤੱਕ ਸਕੂਲ ਜਾਂਦਾ ਉਦੋਂ ਤੱਕ ਉਹਨੇ ਕਾਫੀ ਨੌਲੇਜ ਇਕੱਠੀ ਹੋ ਚੁੱਕੀ ਹੁੰਦੀ ਹੈ ਬੱਚੇ ਦਾ ਟਾਈਮ ਵੀ ਖ਼ਰਾਬ ਨਹੀਂ ਹੁੰਦਾ ਦੂਸਰਾ ਕਿ ਪੜ੍ਹਾਈ ਦੇ ਵਿੱਚ ਉਂਝ ਸਾਨੂੰ ਟੈਕਨੋਲਜੀ ਨੇ ਵੀ ਕਾਫੀ ਜਿੱਥੇ ਤੱਕ ਟੈਕਨੋਲਜੀ ਦੀ ਜੇ ਅਸੀਂ ਕਹਿੰਦੇ ਹਾਂ ਕਿ ਇਹਦੇ ਮਤਲਬ ਕਿ ਅ ਨੁਕਸਾਨ ਹੈ ਉੱਥੇ ਤੱਕ ਇਹਦੇ ਫਾਇਦੇ ਵੀ ਆ ਬੱਚੇ ਮੋਬਾਇਲ ਦੇ ਉੱਤੋਂ ਵੀ ਕਾਫੀ ਕੁਛ ਸਿੱਖਦੇ ਆ ਮੋਬਾਈਲ ਮੋਬਾਈਲ ਤੋਂ ਕਈ ਜਿਹੜੀਆਂ ਚੀਜ਼ਾਂ ਦਾ ਟੋਪਿਕ ਜਿਸ ਤਰ੍ਹਾਂ ਮੰਨ ਲਓ ਕਿ ਸਕੂਲ ਵਿੱਚ ਟੀਚਰ ਨੇ ਕੁਛ ਪੜ੍ਹਾਇਆ ਹੁੰਦਾ ਉਸ ਟਾਈਮ ਨਹੀਂ ਸਮਝ ਆਉਂਦੀ ਘਰ ਆ ਕੇ ਬੱਚਾ ਉਹੀਓ ਚੈਪਟਰ ਨੂੰ ਯੂਟਿਊਬ ਦੇ ਉੱਤੇ ਪਾਉਂਦਾ ਹੈ ਜਿਨ੍ਹਾਂ ਦਾ ਇੰਟਰਸਟ ਹੁੰਦਾ ਬੱਚਿਓ ਉਹ ਮਤਲਬ ਉਹਦੇ 'ਚ ਯੂਟੀਊਬ ਦੇ ਉੱਤੋਂ ਕਾਫੀ ਕਾਫੀ ਕੁਝ ਸਿੱਖ ਲੈਂਦੇ ਆ ਉਹਨਾਂ ਨੂੰ ਪੂਰਾ ਡਿਟੇਲ 'ਚ ਉਹਨਾਂ ਨੂੰ ਸਮਝ ਆ ਜਾਂਦੀ ਹੈ ਫਿਰ ਇਸ ਤੋਂ ਇਲਾਵਾ ਬੱਚੇ ਟਿਊਸ਼ਨ ਜਿਹੜੀ ਖੁੱਲ੍ਹੀਆਂ ਹੋਈਆਂ ਟਿਊਸ਼ਨ 'ਤੇ ਜਾਂਦੇ ਆ ਕਲਾਸ ਵਿੱਚ ਬੱਚੇ ਪਰਸਨਲੀ ਕਿਸੇ ਵੇਲੇ ਟੀਚਰ ਨੂੰ ਨਹੀਂ ਪੁੱਛ ਸਕਦੇ ਕਿ ਮੈਨੂੰ ਇਸ ਇੰਨੀ ਕਲਾਸ ਦੇ ਵਿੱਚ ਫਿਰ ਟੀਚਰ ਵੀ ਇਕੱਲੇ ਇਕੱਲੇ ਬੱਚੇ ਨੂੰ ਐਕਸਪਲੇਨ ਨਹੀਂ ਕਰਕੇ ਦੱਸ ਸਕਦਾ ਟਿਊਸ਼ਨ ਦੇ ਵਿੱਚ ਬੱਚਾ ਖੁੱਲ੍ਹ ਕੇ ਟੀਚਰ ਨਾਲ ਅ ਗੱਲ ਕਰ ਲੈਂਦਾ ਅਤੇ ਆਪਣੇ ਜਿਹੜੇ ਡਾਊਟਸ ਆ ਉਹਨਾਂ ਨੂੰ ਕਲੀਅਰ ਕਰ ਲੈਂਦਾ